ਮੈਂ ਭੌਤਿਕ ਅਤੇ ਇਲੈਕਟ੍ਰੋਨਿਕ ਦੋਨੋਂ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦਾ ਹਾਂ ਪ੍ਰੰਤੂ ਵਧੇਰੇ ਸ਼ੌਕੀਨ ਮੈਂ ਭੌਤਿਕ ਕਿਤਾਬਾਂ ਪੜ੍ਹਨ ਦਾ ਹਾਂ ਜਿਸ ਦਾ ਮੂਲ ਕਾਰਣ ਇਹ ਹੈ ਕਿ ਭੌਤਿਕ ਕਿਤਾਬਾਂ ਹੱਥ ਵਿੱਚ ਫੜ ਕੇ ਇੱਕ ਸੂਖਮ ਅਹਿਸਾਸ ਬਣਦੀਆਂ ਹਨ ਜੋ ਇਲੈਕਟ੍ਰੋਨਿਕ ਕਿਤਾਬਾਂ ਪੜ੍ਹਨ ਵੇਲੇ ਨਹੀਂ ਆਉਂਦਾ ਹਾਂ ਇਲੈਕਟ੍ਰੋਨਿਕ ਕਿਤਾਬਾਂ ਪੜ੍ਹਨ ਦਾ ਇੱਕ ਫ਼ਾਇਦਾ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਜਦੋਂ ਅਸੀਂ ਸਕਰੀਨ ਉੱਤੇ ਪੜ੍ਹਦੇ ਹਾਂ ਤਾਂ ਉਹਨਾਂ ਨੂੰ ਨਾਲ ਲੈ ਕੇ ਜਾਣਾ ਕਿਤੇ ਵੀ ਕਿਉਂ ਕਰਕੇ ਮੋਬਾਇਲ ਵਿੱਚ ਹੀ ਹੁੰਦੀਆਂ ਹਨ ਸੌਖਾ ਹੁੰਦਾ ਹੈ ਜਦੋਂ ਕਿ ਭੌਤਿਕ ਕਿਤਾਬਾਂ ਦਾ ਆਪਣਾ ਇੱਕ ਵਜ਼ਨ ਹੁੰਦਾ ਹੈ ਜਿਸ ਨੂੰ ਸਫ਼ਰ ਦੇ ਦੌਰਾਨ ਚੱਕਣਾ ਔਖਾ ਹੈ ਅਤੇ ਇਹ ਇਲੈਕਟ੍ਰੋਨਿਕ ਕਿਤਾਬਾਂ ਦੇ ਵਿੱਚ ਇੱਕ ਸੌਖਾ ਕਾਰਜ ਹੈ ਇਸ ਤੋਂ ਇਲਾਵਾ ਓਡੀਓ ਬੁੱਕਾਂ ਮੈਂ ਕਦੇ ਬਹੁਤੀਆਂ ਨਹੀਂ ਸੁਣੀਆਂ ਜਿਸ ਦਾ ਮੂਲ ਕਾਰਨ ਇਹ ਹੈ ਕਿ ਕਿਤਾਬਾਂ ਨੂੰ ਸੁਣਨ ਦੀ ਜਗ੍ਹਾ ਮੈਂ ਉਹਨਾਂ ਨੂੰ ਪੜ੍ਹਨਾ ਵਧੇਰੇ ਪਸੰਦ ਕਰਦਾ ਹਾਂ ਕਿਉਂਕਿ ਪੜ੍ਹਨ ਵੇਲੇ ਮੇਰੇ ਕਲਪਨਾ ਦੇ ਚਿੱਤਰ ਪੱਟ ਉੱਤੇ ਉਸ 'ਤੇ ਆਕਾਰ ਸਾਕਾਰ ਹੁੰਦੇ ਹਨ ਜੋ ਕਿ ਓਡੀਓ ਬੁੱਕਾਂ ਦੇ ਵਿੱਚ ਉਸ ਤਰ੍ਹਾਂ ਨਹੀਂ ਹੁੰਦੇ ਓਡੀਓ ਬੁੱਕ ਦੇ ਵਿੱਚ ਅਗਰ ਕੋਈ ਲਾਈਨ ਨਾ ਸਮਝ ਆਵੇ ਤਾਂ ਉਸਨੂੰ ਪਿੱਛੇ ਕਰਕੇ ਦੁਬਾਰਾ ਸੁਣਨਾ ਮੈਨੂੰ ਠੀਕ ਨਹੀਂ ਲੱਗਦਾ ਜਦੋਂ ਕਿ ਕਿਤਾਬ ਦੇ ਉੱਤੇ ਕੋਈ ਚੀਜ਼ ਨਾ ਸਮਝ ਆਵੇ ਤਾਂ ਮੈਂ ਉਸ ਨੂੰ ਕਿੰਨੀ ਹੀ ਵਾਰੀ ਦੁਬਾਰਾ ਦੁਬਾਰਾ ਪੜ੍ਹ ਸਕਦਾ ਹਾਂ ਇਸ ਲਈ ਮੈਂ ਓਡੀਓ ਬੁੱਕਾਂ ਸੁਣਨ ਦੇ ਨਾਲੋਂ ਇਲੈਕਟ੍ਰੋਨਿਕ ਅਤੇ ਭੌਤਿਕ ਕਿਤਾਬਾਂ ਪੜ੍ਹਨੀਆਂ ਵਧੇਰੇ ਪਸੰਦ ਕਰਦਾ ਅਤੇ ਇਲੈਕਟ੍ਰੋਨਿਕ ਅਤੇ ਭੌਤਿਕ ਕਿਤਾਬਾਂ ਦੇ ਵਿੱਚੋਂ ਵੀ ਮੈਨੂੰ ਭੌਤਿਕ ਕਿਤਾਬਾਂ ਪੜ੍ਹਨਾ ਵਧੇਰੇ ਪਸੰਦ ਹੈ